ਹੈਲੋ ਸਤਿ ਸ਼੍ਰੀ ਅਕਾਲ ਸਰ ਸਰ ਤੁਸੀਂ ਗੁਰਲਾਬ ਸਰ ਬੋਲਦੇ ਹੋ ਨਾ ਹਾਂਜੀ ਸਰ ਮੈਂ ਸਹਿਜਵੀਰ ਸਰ ਮੈਂ ਸਹਿਜਵੀਰ ਦੀ ਮੰਮਾ ਬੋਲਦੀ ਹਾਂ ਤੁਹਾਡੇ ਕੋਲ ਡਾਂਸ ਸਿੱਖਦਾ ਹਾਂਜੀ ਸਰ ਸਰ ਉਹਦੀ ਪਰਫੋਰਮੈਂਸਿਸ ਬਾਰੇ ਪੁੱਛਣਾ ਸੀਗਾ ਹਾਂਜੀ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਸਰ ਉਹ ਸਾਏ ਬੜਾ ਹੈਗਾ ਨਾ ਹਾਂਜੀ ਹਾਂਜੀ ਹਾਂਜੀ ਡਰਦਾ ਹੀ ਸਰ ਸਰ ਇੱਕ ਇਹ ਹੈ ਨਾ ਕਿਉਂਕਿ ਡਾਂਸਿੰਗ ਲਈ ਆਪਾਂ ਨੂੰ ਮਤਲਬ ਕਿ ਕੋਨਫੀਡੈਂਸ ਹੋਣਾ ਚਾਹੀਦਾ ਹੈ ਨਾ ਅਤੇ ਉਹ ਇਸ ਕਰਕੇ ਉਹਨੂੰ ਮੈਂ ਤੁਹਾਡੇ ਕੋਲ ਡਾਂਸ ਸਿੱਖਣ ਲਈ ਲਾਇਆ ਸੀਗਾ ਕਿ ਉਹ ਥੋੜ੍ਹਾ ਉਹਦੇ 'ਚ ਕੋਂਨਫੀਡੈਂਸ ਆਵੇ ਹਾਂਜੀ ਹਾਂਜੀ ਹਾਂਜੀ ਸਰ ਸਰ ਮੈਨੂੰ ਇਹਦੇ ਟਾਈਮ ਟਾਈਮ 'ਤੇ ਪਰਫੋਰਮੈਂਸ ਬਾਰੇ ਦੱਸਦੇ ਰਿਹਾ ਕਰੋ ਹਾਂਜੀ ਸਰ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਸਰ